ਹੈਲੋ ਨਮਸਤੇ ਜੀ ਹਾਂਜੀ ਅੱਛਾ ਜੀ ਹਾਂਜੀ ਦੱਸੋ ਹਾਂਜੀ ਹਾਂ ਅੱਛਾ ਜੀ ਕਿਵੇਂ ਅੱਛਾ ਜੀ ਆ ਹੈਗੇ ਆ ਵੈਸੇ ਤਾਂ ਸਾਡੇ ਕੋਲ ਸਮੋਸਾ ਹੈਗਾ ਸਨੈਕਸ ਹੈਗੇ ਆ ਤੇ ਕੁਝ ਚਿਪਸ ਵਗੈਰਾ ਹਾਂਜੀ ਹਾਂਜੀ ਹਾਂਜੀ ਇੱਕ ਵਾਰ ਤਾਂ ਸਾਡੇ ਇੰਨਾ ਈ ਆ ਹ ਬਾਕੀ ਜੇ ਡਿਮਾਂਡ ਹੈਗੀ ਆ ਤਾਂ ਅਸੀਂ ਕਰ ਦਿਆਂਗੇ ਅੱਛਾ ਜੀ ਚਲੋ ਕੋਈ ਨਾ ਵਧਾਵਾਂਗੇ ਹੌਲੀ ਹੌਲੀ ਅਜੇ ਤਾਂ ਅਸੀਂ ਚਲਦੇ ਰਹੇ ਬਸ ਅੱਛਾ ਜੀ ਠੀਕ ਹ ਜੀ ਅੱਛਾ ਠੀਕ ਹ ਕੋਈ ਨਹੀਂ ਤੁਸੀਂ ਕਹਿ ਦਿੱਤਾ ਤੇ ਅਸੀਂ ਕਰਾਂਗੇ ਗੌਰ ਇਸ ਗੱਲ ਤੇ ਵੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹ ਜੀ ਕੋਈ ਨਹੀਂ ਕਾਫੀ ਦਾ ਵੀ ਇਹ ਤਾਂ ਜਰੂਰੀ ਆ ਜੀ ਇਹ ਮਿਲਦੇ ਆ ਇਹ ਤਾਂ ਕਰਾਂਗੇ ਜਰੂਰ ਨੀ ਸਾਡੇ ਨਹੀਂ ਹੁੰਦਾ ਜੀ ਅਜੇ ਤੱਕ ਤਾਂ ਨਹੀਂ ਹ ਠੀਕ ਜੀ ਕੋਈ ਨਾ ਇਹਦਾ ਵੀ ਕਰਦੇ ਆਂ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹ ਜੀ ਚਲੋ ਕੋਈ ਨਾ ਕਰਾਂਗੇ ਕੋਸ਼ਿਸ਼ ਜਰੂਰ ਹਾਂਜੀ ਹਾਂਜੀ ਟੇਬਲ ਦੀ ਨਾ ਇੱਕ ਵਾਰ ਜਗ੍ਹਾ ਹੈ ਨਹੀਂ ਇਸ ਕਰਕੇ ਥੋੜੇ ਘੱਟ ਆ ਕਾਲਜ ਨਾਲ ਗੱਲ ਚੱਲ ਰਹੀ ਹੈ ਤੇ ਉਹ ਜਗਹਾ ਬਣ ਗਈ ਤਾਂ ਉਸ ਤੋਂ ਬਾਅਦ ਜਰੂਰ ਕਰਾਂਗੇ ਜੀ ਟੇਬਲਾਂ ਦਾ ਵੀ ਹਾਂਜੀ ਹਾਂਜੀ ਠੀਕ ਠੀਕ ਹ ਜੀ ਠੀਕ ਹ ਜੀ ਕਰਾਂਗੇ ਜੀ ਚਲ ਰਹੀ ਗੱਲ ਵੈਸੇ ਤਾਂ ਓਕੇ ਜੀ ਓਕੇ